ਛੋਟੇ ਕਾਰੋਬਾਰ ਜਿਵੇਂ ਕਿ ਪਿੰਡਾਂ ਦੇ ਵਿੱਚ ਕਈ ਮੋਬਾਈਲ ਫੋਨ ਦੀ ਸ਼ੋਪ ਕਰ ਲੈਂਦੇ ਆ ਵਿਅਕਤੀ ਅਤੇ ਅਸੀਂ ਹੀ ਮੈਂ ਵੀ ਇੱਕ ਇੱਦਾਂ ਦੇ ਪਰਸਨ ਨੂੰ ਜਾਣਦੀ ਹਾਂ ਉਹਨਾਂ ਨੇ ਹੀ ਆਪਣਾ ਕਾਰੋਬਾਰ ਆਪ ਸ਼ੁਰੂ ਕੀਤਾ ਪਹਿਲਾਂ ਉਹ ਇੱਕ ਮਿਡਲ ਫੈਮਿਲੀ ਦੇ ਵਿਅਕਤੀ ਸਨ ਉਸ ਤੋਂ ਬਾਅਦ ਉਹਨਾਂ ਨੇ ਇੱਕ ਆਪਣਾ ਕਾਰੋਬਾਰ ਆਪ ਖੁਦ ਚਲਾਇਆ ਅਤੇ ਇੱਦਾਂ ਦੇ ਬੰਦਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਅਤੇ ਹਾਂ ਆਪਾਂ ਨੂੰ ਖੁਦ ਆਪਣਾ ਬਿਜਨਸ ਚਲਾਉਣਾ ਚਾਹੀਦਾ ਹੈ ਮੈਂ ਵੀ ਇੱਕ ਦਿਲਚਸਪੀ ਰੱਖਦੀ ਹਾਂ ਮੈਂ ਇੱਕ ਬਹੁਤ ਵਧੀਆ ਆਪਣੀ ਦੁਕਾਨ ਚਲਾਈ ਹੈ ਔਰ ਉਹ ਬਹੁਤ ਹੀ ਵਧੀਆ ਚੱਲਦੀ ਹੈ ਤਾਂ ਇਸੇ ਤਰ੍ਹਾਂ ਹੀ ਇੱਕ ਕਾਰੋਬਾਰ ਤੋਰਨ ਲਈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕਦਮ ਲੈਣਾ ਚਾਹੀਦਾ ਹੈ ਤਾਂ ਇੱਕ ਪੁਆਇੰਟ ਜਿਵੇਂ ਕਿ ਇੱਕ ਛੋਟੀ ਜਿਹੀ ਸ਼ੋਪ ਕਰਕੇ ਉਸ ਤੋਂ ਬਾਅਦ ਦੈਨ ਇੱਕ ਆਪਾਂ ਫੈਕਟਰੀ ਨਾਲ ਡੀਲ ਕਰ ਸਕਦੇ ਆ ਜਾਂ ਇੱਕ ਆਪਾਂ ਮਾਰਕੀਟਿੰਗ ਦਾ ਕੰਮ ਕਰਕੇ ਆਪਣੇ ਜੋ ਬਿਜਨਸ ਹੈ ਉਹਨੂੰ ਅੱਗੇ ਮੋਟੀਵੇਟ ਕਰ ਸਕਦੇ ਹਾਂ ਤਾਂ ਹਾਂ ਇੱਦਾਂ ਦੇ ਬਿਜਨਸ ਛੋਟੇ ਤੋਂ ਛੋਟਾ ਕਰਨਾ ਚਾਹੀਦਾ ਹਰ ਇਕ ਇਨਸਾਨ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ ਅਤੇ ਮੇਰੇ ਅਕੋਰਡਿੰਗ ਤਾਂ ਕਾਰੋਬਾਰ ਆਪਣਾ ਆਪ ਖੁਦ ਆਪਣਾ ਕਰਨਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਹਰ ਇੱਕ ਲੇਡੀ ਨੂੰ ਹਰ ਇੱਕ ਬੱਚੇ ਨੂੰ ਜੋ ਕਿ ਇੱਕ ਮਚਿਓਰ ਲਾਈਫ ਡਿਪੈਂਡ ਕਰ ਰਿਹਾ